ਮੈਂ ਆਪਣੀ ਹਰ ਰੋਜ਼ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਦੀ ਹਾਂ ਇਸ ਰੂਪਨਗਰ ਜ਼ਿਲ੍ਹੇ ਦੇ ਲੋਕ ਵੀ ਉਸੇ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਅਤੇ ਬਹੁਤ ਪਰੇਸ਼ਾਨ ਹਨ ਜਿਵੇਂ ਕਿ ਰੋਪੜ ਦਾ ਬੱਸ ਅੱਡਾ ਜੋ ਕਿ ਬਹੁਤ ਹੀ ਦੂਰ ਬਣਾਏ ਬਣਾ ਬਣਾਇਆ ਜਾ ਰਿਹਾ ਹੈ ਜਿਸ ਤੋਂ ਲੋਕ ਬਹੁਤ ਪਰੇਸ਼ਾਨ ਹਨ ਅਤੇ ਉਹ ਆਪਣੀਆਂ ਬੱਸਾਂ ਲੈਣ ਲਈ ਵੀ ਬਹੁਤ ਦਿੱਕਤ ਪਰੇਸ਼ਾਨੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਤੋਂ ਇਲਾਵਾ ਲੋਕਾਂ ਦੀਆਂ ਗਲੀਆਂ ਨਾਲੀਆਂ ਜਦੋਂ ਹ ਭਾਰੀ ਵਰਖਾ ਹੁੰਦੀ ਹੈ ਉਸ ਉਸ ਟਾਈਮ ਅਤੇ ਭਰ ਜਾਂਦੀਆਂ ਹਨ ਅਤੇ ਕਿਧਰੇ ਵੀ ਪਾਣੀ ਦਾ ਨਿਕਾਸ ਨਹੀਂ ਹੈ ਜਿਸ ਤੋਂ ਲੋਕ ਬਹੁਤ ਪਰੇਸ਼ਾਨ ਹੁੰਦੇ ਹਨ ਅਤੇ ਮੈਂ ਇਹੀ ਲੀਡਰਾਂ ਤੋਂ ਮਦਦ ਮੰਗਦੀ ਹਾਂ ਕਿ ਉਹ ਉਨ੍ਹਾਂ ਦਾ ਹੱਲ ਕੱਢਿਆ ਜਾਵੇ ਅਤੇ ਲੋਕਾਂ ਦੀ ਇਹ ਦੁੱਖ ਤਕਲੀਫ਼ਾਂ ਨੂੰ ਸੁਣਿਆ ਜਾਵੇ